ਪੰਜਾਬ 'ਚ ਜੇ ਕਿਸੇ ਬਾ ਬਾਹਰੋਂ ਕਿਸੇ ਸੈਲਾਨੀ ਨੇ ਕੋਈ ਮਨੋਰੰਜਨ ਕਰਨ ਲਈ ਜਾਂ ਕੋਈ ਵੀ ਤਿਉਹਾਰ ਵੇਖਣ ਲਈ ਆਉਣਾ ਹੈ ਤਾਂ ਤਿਉਹਾਰ ਦੀਵਾਲੀ ਸਭ ਤੋਂ ਵਧੀਆ ਤਿਉਹਾਰ ਹੈ ਪੰਜਾਬ ਦਾ ਇਹ ਇਹ ਤਿਉਹਾਰ ਵੇਖਣ ਲਈ ਆਉਣਾ ਆਓ ਦਸ ਦੀਵਾਲੀ ਤੋਂ ਦਸ ਦਿਨ ਪਹਿਲਾਂ ਹੀ ਰੌਣਕਾਂ ਸ਼ੁਰੂ ਹੋ ਜਾਂਦੀਆ ਹਨ ਦੁਸ਼ਹਿਰਾ ਦੁਸ਼ਹਿਰੇ ਤੋਂ ਬਾਅਦ ਦੁਸ਼ਹਿਰਾ ਆਉਂਦਾ ਪਹਿਲਾਂ ਦੀਵਾਲੀ ਤੋਂ ਫਿਰ ਰਾਮਲੀਲ੍ਹਾ ਲੱਗਣ ਲੱਗ ਜਾਂਦੀ ਹੈ ਗਰ ਰਾਮਲੀਲ੍ਹਾ ਦੇਖਣ ਵਾਲੀ ਹੁੰਦੀ ਰਾਤ ਨੂੰ ਫਿਰ ਦੀਵਾਲੀ ਵਾਲੇ ਸਜਾਵਟਾਂ ਸ਼ੁਰੂ ਹੋ ਜਾਂਦੀਆਂ ਹਨ ਸਜਾਵਟਾਂ ਸ਼ੁਰੂ ਹੋ ਘਰ ਸਜਾਉਂਦੇ ਆ ਸਫਾਈਆਂ ਸ਼ੁਰੂ ਹੁੰਦੀਆਂ ਬਜ਼ਾਰ ਸੱਜਣੇ ਸ਼ੁਰੂ ਹੋ ਜਾਂਦੇ ਆ ਜਾਂ ਬਜ਼ਾਰਾਂ ਦੀਆਂ ਰੌਣਕਾਂ ਵਧ ਜਾਂਦੀਆਂ ਹਨ ਹੌਲੀ ਹੌਲੀ ਰੌਣਕਾਂ ਵੱਧ ਜਾਂਦੀਆਂ ਪਟਾਕੇ ਆ ਜਾਂਦੇ ਦੁਕਾਨਾਂ 'ਤੇ ਪਟਾਕੇ ਵੱਜਣੇ ਸ਼ੁਰੂ ਹੋ ਜਾਂਦੇ ਮੰਦਿਰ ਗੁਰਦੁਆਰੇ ਸੱਜ ਜਾਂਦੇ ਸਭ ਤੋਂ ਜ਼ਿਆਦਾ ਤਾਂ ਦੀਵਾਲੀ ਦੇ ਵਧੀਆ ਪੰਜਾਬ ਵਿੱਚ ਦੇਖਣਯੋਗ ਅੰਬਰਸਰ ਦੀ ਹੈ ਅੰਬਰਸਰ ਦੀ ਦੀਵਾਲੀ ਬਹੁਤ ਵਧੀਆ ਮਨਾਈ ਜਾਂਦੀ ਹੈ ਧੂਮ ਧਾਮ ਨਾਲ ਦੂਰੋਂ ਦੂਰੋਂ ਸੈਲਾਨੀ ਉੱਥੇ ਦੀਵਾਲੀ ਦੇਖਣ ਜਾਂਦੇ ਆ ਪੰਜਾਬ ਦਾ ਸ਼ੁੱਭ ਤਿਉਹਾਰ ਸਭ ਤੋਂ ਵਧੀਆ ਦ ਦੀਵਾਲੀ ਹੈ ਦੇਖਣਯੋਗ ਹੈ ਇਸ ਨੂੰ ਆਓ ਅਤੇ ਜਾਓ ਦੇਖੋ